ਮੈਂ ਗੁਰਰਾਜ ਕੁਮਾਰ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਜਿਵੇਂ ਕਿ ਗੱਲ ਕਰੀਏ ਅੱਜ ਮੋਟਰਸਾਈਕਲ ਬਾਰੇ ਕਿ ਮੋਟਰਸਾਈਕਲ ਦੇ ਚਲਾਨ ਨਾਲ ਸਾਨੂੰ ਕੀ ਪ੍ਰਭਾਵਿਤ ਹੁੰਦਾ ਹੈ ਉਸ ਤੋਂ ਸਾਨੂੰ ਕੀ ਫਾਇਦਾ ਹੈ ਅਤੇ ਕੀ ਨੁਕਸਾਨ ਹਨ ਜੇਕਰ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਟੂ ਵੀਹਲਰ ਹੈ ਜਿਸ 'ਤੇ ਅਸੀਂ ਕਿਤੇ ਵੀ ਜਾਣਾ ਹੋਵੇ ਤਾਂ ਅਸੀਂ ਦੋ ਬੰਦੇ ਆਰਾਮ ਨਾਲ ਜਾ ਸਕਦੇ ਹਾਂ ਜਿਵੇਂ ਅਸੀਂ ਅੰਮ੍ਰਿਤਸਰ ਗੁਰਦਾਸਪੁਰ ਕਿਤੇ ਵੀ ਜਾਵਾਂਗੇ ਬੱਸ 'ਤੇ ਸਾਨੂੰ ਕਾਫੀ ਟਾਈਮ ਬੱਸ ਅੱਡੇ ਵਿੱਚ ਬੱਸ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਜਿਸ ਵਿੱਚ ਬੱਸ ਮਿਲਣ 'ਤੇ ਸਾਡਾ ਖਰਚਾ ਜ਼ਿਆਦਾ ਹੋਵੇਗਾ ਕੀ ਬਾਈਕ ਵਿਚ ਅਸੀਂ ਕਮ ਘੱਟ ਖਰਚੇ ਵਿੱਚ ਦੋ ਬੰਦੇ ਜਾ ਸਕਦੇ ਹਾਂ ਜਿਵੇਂ ਕਿ ਬਾਈਕ ਅੱਜ ਕੱਲ੍ਹ ਗੱਡੀਆਂ ਰੋਡ ਦੇ ਉੱਪਰ ਬਹੁਤ ਜਾਮ ਲੱਗਦਾ ਹੈ ਜਿਸ ਕਾਰਨ ਬੱਸਾਂ ਕਈ ਕਈ ਘੰਟੇ ਜਾਮ ਵਿੱਚ ਰੁਕੀਆਂ ਰਹਿੰਦੀਆਂ ਹਨ ਪਰ ਜੇਕਰ ਇੱਕ ਪਾਸੇ ਅਸੀਂ ਮੋਟਰਸਾਈਕਲ ਬਾਈਕ ਦੀ ਗੱਲ ਕਰਦੇ ਹਾਂ ਤਾਂ ਬਾਈਕ ਆਲੇ ਦੁਆਲੇ ਜਾਂ ਆਸੇ ਪਾਸਿਓ ਅਸੀਂ ਬਾਈਕ ਨਿਕਾਲ ਸਕਦੇ ਹਾਂ ਜਾਂ ਜਿੱਥੇ ਵੀ ਜਾਣਾ ਹੋਵੇ ਸਮੇਂ ਸਿਰ ਪੁੱਜ ਜਾਂਦੇ ਹਾਂ ਜੇਕਰ ਬਾਈਕ ਦੀ ਗੱਲ ਕਰੀਏ ਬਾਈਕ ਚਲਾਉਂਦਿਆਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਪਰ ਕਈ ਲੋਕ ਇਸ ਦਾ ਗਲਤ ਇਸਤੇਮਾਲ ਕਰਦੇ ਹਨ ਜਿਵੇਂ ਕਿ ਬਾਈਕ ਨੂੰ ਚਲਾਉਂਦਿਆਂ ਹੋਇਆ ਸਟੰਟ ਕਰਨਾ ਜਾਂ ਗਲਤ ਚਲਾਉਣਾ ਜਾਂ ਗਲਤ ਪੀ ਕੇ ਡਰਾਈਵ ਕਰਨੀ ਜਾਂ ਨਸ਼ੇ ਵਿੱਚ ਮੋਟਰਸਾਈਕਲ ਚਲਾਉਣਾ ਉਸਦੇ ਨਾਲ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਜੇਕਰ ਅਸੀਂ ਸੋਚੀਏ ਤਾਂ ਬਾਈਕ ਸਾਡੇ ਇੱਕ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਹੈ ਜਿਵੇਂ ਕਿ ਸਾਨੂੰ ਟਾਇਮ ਟਾਈਮ 'ਤੇ ਉਸ ਦੀ ਜ਼ਰੂਰਤ ਪੈਂਦੀ ਹੈ ਜਾਂ ਨੇੜੇ ਜਾਣਾ ਜਾਂ ਦੂਰ ਪਾਰ ਜਾਣਾ ਜਾਂ ਕਿਤੇ ਅਸੀਂ ਵਿਆਹ ਸ਼ਾਦੀ ਜਾਣਾ ਜਾਂ ਕਿਸੇ ਹੋਸਪਿਟਲ ਜਾਂ ਸਰਕਾਰੀ ਕੰਮ ਲਈ ਜਾਂਦੇ ਹਾਂ ਤਾਂ ਅਸੀਂ ਬਾਈਕ 'ਤੇ ਇਜ਼ੀਲੀ ਜਾ ਸਕਦੇ ਹਾਂ ਪਲਸ ਬਾਈਕ 'ਤੇ ਸਾਨੂੰ ਸਿਰਫ ਕੋਈ ਟੋਲ ਜਾਂ ਟੈਕਸ ਕਟਵਾਉਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਇਸ ਦੇ ਫਾਇਦੇ ਇਹ ਹਨ ਕਿ ਅਸੀਂ ਇਸ ਨੂੰ ਬੜੇ ਆਰਾਮ ਨਾਲ ਚਲਾਈਏ ਤਾਂ ਸਾਨੂੰ ਬਹੁਤ ਫਾਇਦੇਮੰਦ ਲੱਗਦੀ ਹੈ ਬਾਈਕ ਮੇਰੀ ਮਨਪਸੰਦ ਹੈ ਮੈਨੂੰ ਬਾਈਕ ਚਲਾਉਂਦਿਆਂ ਬਹੁਤ ਹੀ ਅੱਛਾ ਪ੍ਰਭਾਵਿਤ ਹੁੰਦਾ ਹਾਂ ਤਾਂ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਇਹੋ ਗੱਲ ਸਮਝਾਉਂਦਾ ਹਾਂ ਕਿ ਬਾਈਕ ਨੂੰ ਧਿਆਨ ਨਾਲ ਚਲਾਓ